ਮਨਪਸੰਦ ਗੀਤ ਭਜਨ ਜਿਸ ਤਰ੍ਹਾਂ ਭਜਨ ਨਾਲ ਬਹੁਤ ਅੱਛਾ ਲੱਗਦਾ ਹੈ ਸਵੇਰੇ ਸਵੇਰੇ ਭਜਨ ਲੱਗੇ ਹੋਣ ਤਾਂ ਬਹੁਤ ਸ਼ਾਂਤੀ ਮਤਲਬ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਬਹੁਤ ਰੀਲੈਕਸ ਫੀਲ ਹੁੰਦਾ ਹੈ ਉਸ ਤੋਂ ਬਾਅਦ ਓਲਡ ਹਿੰਦੀ ਸੌਂਗ ਜੋ ਮੈਨੂੰ ਆਲ ਟਾਈਮ ਬਹੁਤ ਪਸੰਦ ਹੈ ਹਿੰਦੀ ਸੌਂਗ ਲਗਾ ਕੇ ਮਤਲਬ ਮੈਂ ਆਪਣਾ ਪੂਰਾ ਘਰ ਦਾ ਕੰਮ ਕਰਦੀ ਹਾਂ ਔਰ ਮੈਨੂੰ ਸੁਣਨੇ 'ਚ ਬਹੁਤ ਅੱਛੇ ਲੱਗਦੇ ਹਨ ਉਸ ਤੋਂ ਇਲਾਵਾ ਇੰਗਲਿਸ਼ ਸੌਂਗ ਪੰਜਾਬੀ ਸੌਂਗ ਕਦੀ ਮਸਤੀ ਦੇ ਮੂਡ 'ਚ ਹੋ ਤਾਂ ਪੰਜਾਬੀ ਸੌਂਗ ਬਹੁਤ ਅੱਛੇ ਲੱਗਦੇ ਨੇ ਸੁਣਨੇ 'ਚ ਔਰ ਡਾਂਸ ਵਗੈਰਾ ਕਰਨੇ 'ਚ